ਸਮਾਜਿਕ ਯੋਗਦਾਨ ਇਹ ਹੈ ਕਿ ਜਿਹੜੇ ਸਾਡੇ ਪੰਜਾਬ ਨੇ ਪਾਕਿਸਤਾਨੀ ਬਾਰਡਰ ਨੂੰ ਸੰਭਾਲਿਆ ਹੋਇਆ ਹੈ ਇੱਥੋਂ ਤੱਕ ਉੱਨੀ ਸੌ ਬਹੱਤਰ ਦੀ ਲੜਾਈ ਪੰਜਾਬੀਆਂ ਕਰਕੇ ਜਿੱਤੀ ਗਈ ਇਸ ਤੋਂ ਇਲਾਵਾ ਪੰਜਾਬ ਪੂਰੇ ਭਾਰਤ ਹੀ ਨਹੀਂ ਬਲਕਿ ਹੋਰ ਦੇਸ਼ਾਂ ਨੂੰ ਵੀ ਸਬਜ਼ੀਆਂ ਅਤੇ ਫਲ਼ ਸਪਲਾਈ ਕਰਦਾ ਹੈ ਕਿਉਂਕਿ ਇੱਥੇ ਹਰੀ ਕ੍ਰਾਂਤੀ ਕਰਕੇ ਉਤਪਾਦਕਤਾ ਬਹੁਤ ਜ਼ਿਆਦਾ ਵਧੀ ਹੈ ਇਹ ਸਭ ਸਾਡੇ ਖੇਤੀਬਾੜੀ ਵਿਗਿਆਨੀਆਂ ਦੀ ਦੇਣ ਹੈ ਅਤੇ ਸਾਰੀਆਂ ਕੱਪੜੇ ਦੀਆਂ ਫੈਕਟਰੀਆਂ ਜ਼ਿਆਦਾਤਰ ਉੱਤਰ ਭਾਰਤ ਵਿੱਚ ਹੀ ਮੌਜੂਦ ਹਨ ਇਸ ਤੋਂ ਬਿਨਾਂ ਪੰਜਾਬ ਦਾ ਸੱਭਿਆਚਾਰ ਪ੍ਰੋਗਰਾਮ ਜਿਵੇਂ ਕਿ ਗਿੱਧਾ ਭੰਗੜਾ ਦੁਨੀਆ ਭਰ ਵਿੱਚ ਮਸ਼ਹੂਰ ਹੈ ਅਤੇ ਪੰਜਾਬੀਆਂ ਦਾ ਮੁੱਖ ਧਰਮ ਵੀ ਸੰਗੀਤ ਨਾਲ਼ ਜੋੜਦਾ ਹੈ ਵਿਗਿਆਨਿਕ ਤਕਨੋਲੋਜੀ ਕਰਕੇ ਦਰਬਾਰ ਸਾਹਿਬ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਨ ਦੁਨੀਆ ਭਰ ਵਿੱਚ ਬੈਠੇ ਸਿੱਖਾਂ ਤੱਕ ਪਹੁੰਚਾਇਆ ਜਾਂਦਾ ਹੈ ਵਿਗਿਆਨਿਕ ਤਕਨੋਲੋਜੀ ਕਰਕੇ ਹੀ ਸਾਰੇ ਧਰਮਾਂ ਦੇ ਗ੍ਰੰਥਾਂ ਨੂੰ ਅਲੱਗ ਅਲੱਗ ਭਾਸ਼ਾ ਵਿੱਚ ਤਬਦੀਲ ਕੀਤਾ ਗਿਆ